ਹੈਲੋ ਸਤਿ ਸ਼੍ਰੀ ਅਕਾਲ ਜੀ ਗੂਰੀ ਕਾਰ ਡੀਲਰ ਤੋਂ ਬੋਲਦੇ ਜੀ ਸਰ ਮੈਂ ਨਾ ਤੁਹਾਡੀ ਐਡ ਦੇਖੀ ਸੀ ਮੈ ਨਾ ਦਿੱਲੀ ਨੰਬਰ ਮੈਨੂੰ ਗੱਡੀ ਚਾਹੀਦੀ ਸੀ ਸੈਕਿੰਡ ਹੈਂਡ ਆਪਣੇ ਕੋਲ਼ ਕਿਹੜੀ ਕਿਹੜੀ ਗੱਡੀਆਂ ਨੇ ਹਾਂਜੀ ਹਾਂਜੀ ਆਹ ਸਕੋਰਪੀਓ ਵੀ ਹੈਗੀ ਹੈ ਜੀ ਸਕੋਰਪੀਓ ਦਾ ਮੋਡਲ ਕਿੰਨਾ ਜੀ ਦੋ ਹਜ਼ਾਰ ਸਤਾਰਾਂ ਮਾਡਲ ਡੀਜ਼ਲ ਅਤੇ ਇਹਦਾ ਰੰਗ ਕਿਹੜਾ ਹੋਊਗਾ ਜੀ ਬਲੈਕ ਅਤੇ ਇਹਦੇ ਇਹਦੇ ਬਾਰੇ ਮੈਨੂੰ ਥੋੜਾ ਜਿਹਾ ਦੱਸ ਦਿਉ ਸਕੋਰਪੀਓ ਬਾਰੇ ਔਨਰ ਕਿੰਨਵਾਂ ਜੀ ਠੀਕ ਹੈ ਜੀ ਟਾਇਰ ਠੀਕ ਹੈ ਜੀ ਠੀਕ ਹੈ ਜੀ ਅਤੇ ਤੁਸੀਂ ਮੈਨੂੰ ਏ ਇਹਦੀਆਂ ਫੋਟੋਆਂ ਮੈਨੂੰ ਵੱਅਟਸਐਪ ਕਰ ਦੇਵੋਗੇ ਜੀ ਠੀਕ ਹੈ ਜੀ ਮੇਰਾ ਆਹੀ ਵੱਅਟਸਐਪ ਨੰਬਰ ਹੈ ਤੁਸੀਂ ਮੈਨੂੰ ਇਸ 'ਤੇ ਸੈਂਡ ਕਰ ਦਿਓ ਜੀ ਬਾਕੀ ਫਿਰ ਦੇਖਣ ਆਉਣਾ ਫਿਰ ਅਸੀਂ ਤੁਹਾਡੇ ਦਫ਼ਤਰ ਆ ਕੇ ਗੱਡੀ ਦੇਖ ਲਵਾਂਗੇ ਜੀ ਜੀ ਠੀਕ ਹੈ ਥੈਂਕ ਯੂ